ਸਤਿ ਸ਼੍ਰੀ ਅਕਾਲ ਜੀ ਮੈਂ ਪੰਦਰਾਂ ਦਿਨ ਪਹਿਲਾਂ ਤੁਹਾਡੇ ਕੋਲ਼ੋਂ ਫੋਨ ਮੰਗਵਾਇਆ ਸੀ ਜੋ ਕਿ ਜਦੋਂ ਮੇਰੇ ਪਾਸ ਪਹੁੰਚਿਆ ਤਾਂ ਉਸ ਦੀ ਪੈਕਿੰਗ ਬਹੁਤ ਵਧੀਆ ਸੀ ਅਤੇ ਜਦੋਂ ਮੈਂ ਉਸਨੂੰ ਖੋਲ੍ਹ ਕੇ ਆਪਣੇ ਹੱਥ ਵਿੱਚ ਫੜਿਆ ਤਾਂ ਹੱਥ ਵਿੱਚ ਫੜਿਆ ਹੋਇਆ ਫੋਨ ਬਹੁਤ ਵਧੀਆ ਲੱਗ ਰਿਹਾ ਸੀ ਉਸਦਾ ਕੈਮਰਾ ਜੋ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਉਸਦਾ ਚਾਰਜਰ ਤੀਹ ਮਿੰਟ 'ਚ ਸੱਠ ਪ੍ਰਸੈਂਟ ਫੋਨ ਚਾਰਜ ਕਰ ਦਿੰਦਾ ਹੈ ਅਤੇ ਉਸ ਨਾਲ ਜੋ ਹੈੱਡਫੋਨ ਮਿਲੇ ਹਨ ਉਹਨਾਂ ਹੈੱਡਫੋਨਾਂ 'ਚ ਆਵਾਜ਼ ਵੀ ਬਿਲਕੁਲ ਸਾਫ ਆਉਂਦੀ ਹੈ ਅਤੇ ਉਹ ਫੋਨ ਦੀ ਸਕਰੀਨ ਵੀ ਵਧੀਆ ਚੱਲ ਤਰੀਕੇ ਨਾਲ ਚੱਲਦੀ ਹੈ ਅਤੇ ਉਸਦਾ ਫੋਨ ਅਤੇ ਉਹ ਫੋਨ ਲਾਈਟਵੇਟ ਹੈ ਅਤੇ ਮੈਨੂੰ ਉਹ ਫੋਨ ਬਹੁਤ ਵਧੀਆ ਲੱਗਿਆ ਅਤੇ ਸਾਡੇ ਘਰਦਿਆਂ ਨੂੰ ਵੀ ਉਹ ਫੋਨ ਬਹੁਤ ਵਧੀਆ ਲੱਗਿਆ ਅਤੇ ਸਾਡੇ ਘਰਦਿਆਂ 'ਚੋਂ ਕਿਸੇ ਇੱਕ ਮੈਂਬਰ ਨੇ ਵੀ ਉਹ ਫੋਨ ਔਡਰ ਕੀਤਾ ਹੈ ਧੰਨਵਾਦ